ਪਿਛਲੇ ਦਿਨੀਂ ਮੈਂ ਇੱਕ ਔਡਰ ਕਰਕੇ ਈ ਬੁੱਕ ਮੰਗਵਾਈ ਹੈ ਈ ਬੁੱਕ ਮੰਗਵਾਉਣ ਦੇ ਮੈਨੂੰ ਕੋਈ ਵੀ ਪੋਜੀਟਿਵ ਐਕਸਪੀਰੀਅੰਸ ਹੋਏ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਨਾਂ ਦੇ ਵਿੱਚ ਪਹਿਲਾਂ ਇਹ ਹੈ ਕਿ ਈ ਬੁੱਕ ਮੈਨੂੰ ਕਾਫੀ ਸਸਤੀ ਮਿਲੀ ਹੈ ਅਤੇ ਇਹਦੇ ਵਿੱਚ ਜਿਹੜੀ ਸਕ੍ਰਿਪਟ ਵਰਤੀ ਹੋਈ ਹੈ ਉਹ ਵੀ ਕਾਫੀ ਚੰਗੀ ਹੈ ਇਸ ਤੋਂ ਬਿਨਾਂ ਇਸ ਨੂੰ ਕਿਸੇ ਵੀ ਸਫਰ ਦੇ ਦੌਰਾਨ ਆਪਾਂ ਬੜੀ ਆਸਾਨੀ ਦੇ ਨਾਲ ਕਿਉਂ ਕਰਕੇ ਆਪਣੇ ਮੋਬਾਇਲ ਦੇ ਵਿੱਚ ਹੀ ਹੁੰਦੀ ਹੈ ਪੜ੍ਹ ਸਕਦਾ ਆ ਸਕਰੀਨ ਦੇ ਉੱਤੇ ਟਾਈਮ ਲਾ ਕੇ ਅਤੇ ਮੈਂ ਵੀ ਪਿਛਲੇ ਦਿਨੀਂ ਜਦੋਂ ਆਪਣੇ ਸਫਰ ਦੇ ਵਿੱਚ ਸੀਗਾ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਈ ਬੁੱਕ ਨੂੰ ਮੈਂ ਲਗਾਤਾਰ ਸਫਰ ਦੇ ਦੌਰਾਨ ਪੜ੍ਹਦਾ ਰਿਹਾ ਜਿਸ ਕਰਕੇ ਸਫਰ ਵਾਲਾ ਸਮਾਂ ਏ ਜਿਹੜਾ ਮੇਰਾ ਉਹ ਚੰਗਾ ਵੀ ਬਤੀਤ ਹੋਇਆ ਇਸ ਤੋਂ ਬਿਨਾਂ ਕੁਝ ਮੇਰੇ ਦੋਸਤ ਜਿਹੜੇ ਮੇਰੇ ਲਿੰਕ ਦੇ ਵਿੱਚ ਨੇ ਮੈਂ ਉਹਨਾਂ ਨੂੰ ਵੀ ਇਹ ਕਿਤਾਬ ਸੈਂਡ ਕੀਤੀ ਅੱਗੇ ਇ ਇਸ ਤੋਂ ਬਿਨਾਂ ਜਿਸ ਥਾਂ ਤੋਂ ਮੈਂ ਈ ਬੁੱਕ ਔਡਰ ਕੀਤੀ ਸੀ ਉਹਨਾਂ ਨੇ ਕੁਝ ਮੈਨੂੰ ਹੋਰ ਅੋਫਰ ਵੀ ਭੇਜੇ ਨੇ ਕਿ ਤੁਸੀਂ ਹੋਰ ਈ ਬੁੱਕਸ ਹੈ ਜਿਹੜੀਆਂ ਉਹ ਸਾਡੇ ਕੋਲੋਂ ਮੰਗਵਾ ਸਕਦੇ ਓਂ ਅਤੇ ਭਵਿੱਖ ਦੇ ਵਿੱਚ ਅਸੀਂ ਹੋਰ ਇਸ ਤਰ੍ਹਾਂ ਦੇ ਔਡਰ ਤੁਹਾਨੂੰ ਭੇਜਦੇ ਰਹਾਂਗੇ ਇਸ ਰੂਪ ਦੇ ਵਿੱਚ ਵੀ ਈ ਬੁੱਕ ਮੰਗਵਾਉਣ ਦਾ ਮੈਨੂੰ ਜਿਹੜਾ ਫਾਇਦਾ ਉਹ ਹੋਇਆ ਏ ਤੀਜਾ ਇਹਨੂੰ ਚੱਕਣਾ ਸੌਖਾ ਏ ਜਿਹੜੀ ਹਾਰਡ ਬਾਉਂਡਿੰਗ ਆ ਉਹਨੂੰ ਚੱਕਣਾ ਔਖਾ ਏ ਇਹਨੂੰ ਆਪਾਂ ਕਿਤੇ ਵੀ ਫੋਨ ਦੇ ਵਿੱਚ ਕਿਉਂ ਕਰਕੇ ਹੋਣ ਕਰਕੇ ਲਿਜਾ ਸਕਦੇ ਹਾਂ ਇਸ ਰੂਪ ਦੇ ਵਿੱਚ ਇਹ ਚੰਗੀ ਹੈ ਇਹ ਕੁਝ ਈ ਬੁੱਕ ਦੇ ਪੋਜੀਟਿਵ ਐਕਸਪੀਰੀਅੰਸ ਜੋ ਮੇਰੇ ਨਾਲ ਵਾਪਰੇ ਨੇ ਧੰਨਵਾਦ